ਮੇਰੇ ਮਨ ਪਸੰਦ ਕੁਝ ਮੁਹਾਵਰੇ ਜੋ ਕਿ ਨਿਮਿਨਲਿਖਿਤ ਅਨੁਸਾਰ ਹਨ ਮੈਂ ਉਹਨਾਂ ਬਾਰੇ ਤੁਹਾਨੂੰ ਸਪੱਸ਼ਟ ਰੂਪ ਵਿੱਚ ਉਹਨਾਂ ਦਾ ਅਰਥ ਦੱਸਾਂਗੀ ਜਿਵੇਂ ਕਿ ਪਹਿਲਾ ਮੁਹਾਵਰਾ ਉੱਠੇ ਤਾਂ ਉੱਠ ਨਹੀਂ ਤਾ ਰੇਤ ਦੀ ਮੁੱਠ ਜਿਹੜਾ ਬੰਦਾ ਕੰਮ ਨਹੀ ਕਰਦਾ ਉਹ ਬੇਕਾਰ ਹੈ ਭਾਵ ਬੰਦਾ ਕੰਮ ਕਰਦਾ ਹੀ ਸ਼ੋਭਦਾ ਹੈ ਨਿਕੰਮਾ ਬੰਦਾ ਜਿਹਾ ਹੋਇਆ ਤਿਹਾ ਨਾ ਹੋਇਆ ਸਿਆਣੇ ਕਹਿੰਦੇ ਹਨ ਉੱਠੇ ਤਾਂ ਉੱਠ ਨਹੀ ਤਾਂ ਰੇਤ ਦੀ ਮੁੱਠ ਅੱਗੇ ਸੱਪ ਦੇ ਪਿੱਛੇ ਛੀਂ ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋ ਆਦਮੀ ਮੁਸ਼ਕਿਲਾਂ ਜਾ ਡਰ ਕਾਰਨ ਨਾ ਅੱਗੇ ਜਾ ਸਕੇ ਨਾ ਪਿੱਛੇ ਮੁੜ ਸਕੇ ਭਾਵ ਜਿਹੜੇ ਲੋਕ ਕਰਜੇ ਚੁੱਕੇ ਏਜੰਟਾਂ ਦੇ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾਂਦੇ ਹਨ ਉਹਨਾਂ ਦੇ ਹਾਲਤ ਅੱਗੇ ਸੱਪ 'ਤੇ ਪਿੱਛੇ ਛੀ ਵਾਲੀ ਹੋ ਜਾਂਦੀ ਹੈ ਆਪਣੀ ਅਕਲ 'ਤੇ ਪਰਾਇਆ ਧਨ ਬਹੁਤ ਜਾਪਦਾ ਹੈ ਜਦੋਂ ਕੋਈ ਆਪਣੀ ਅਕਲ 'ਤੇ ਦੂਜੇ ਧਨ ਦੀ ਵਡਿਆਈ ਕਰੇ ਤਦ ਇਸ ਠੀਕ ਨਾ ਸਮਝਣ ਵਾਲਾ ਇਸ ਅਖਾਣ ਦੀ ਵਰਤੋਂ ਕਰਦਾ ਹੈ ਆਪਣੇ ਹੱਥੀਂ ਆਪਣਾ ਆਪ ਹੀ ਕਾਜ ਸਵਾਰਿਆ ਇਸ ਅਖਾਣ ਦੀ ਵਰਤੋਂ ਆਪਣੇ ਹੱਥੀਂ ਕੀਤੇ ਕੰਮ ਦੀ ਮਹਾਨਤਾ ਦਰਸਾਉਣ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਭਾਈ ਗੁਰਬਾਣੀ ਕਹਿੰਦੀ ਹੈ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਇਆ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੰਮ ਸਿਰ ਠੀਕ ਠਾਕ ਹੋ ਜਾਵੇ ਤਾ ਤੁਸੀਂ ਪਰਾਈ ਆਸ ਛੱਡ ਕੇ ਆਪ ਹੀ ਕੰਮ ਵਿੱਚ ਜੁੱਟ ਜਾਵੋ ਕੋਹ ਨਾ ਚਲੀ ਬਾਬਾ ਤਿਹਾਈ ਥੋੜ੍ਹਾ ਜਿਹਾ ਕੰਮ ਕਰਕੇ ਹੀ ਥੱਕ ਜਾਣਾ ਜਿਵੇਂ ਕਿ ਗੁਰਜੋਤ ਤੂੰ ਤਾ ਕਹਿੰਦੀ ਸੀ ਕਿ ਮੈਂ ਤੁਹਾਡੇ ਵਾਂਗ ਸਾਰੀ ਰਾਤ ਜਾਗ ਕੇ ਕੰਮ ਕਰ ਸਕਦੀ ਹਾਂ ਪਰ ਹੁਣ ਤੂੰ ਸਾਢੇ ਦਸ ਵਜੇ ਹੀ ਕਹਿ ਰਹੀ ਐਂ ਕਿ ਮੈਂ ਥੋੜ੍ਹਾ ਜਿਹਾ ਲੰਮੀ ਪੈ ਲਵਾਂ ਮੈਨੂੰ ਨੀਂਦ ਬਹੁਤ ਚੜ੍ਹੀ ਹੈ ਤੇਰੀ ਤਾਂ ਉਹ ਗੱਲ ਹੈ ਕੋਹ ਨਾ ਚਲੀ ਬਾਬਾ ਤਿਹਾਈ ਅਜੇ ਤਾਂ ਰਾਤ ਬਹੁਤ ਲੰਮੀ ਪਈ ਹੈ